ਹਾਂਜੀ ਜਿਵੇਂ ਸਾਨੂੰ ਪਤਾ ਹੈ ਕਿ ਕੋਈ ਸਰਕਾਰੀ ਕੰਮ ਕਰਾਉਣ ਲਈ ਸਾਨੂੰ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ ਭਾਵੇਂ ਸਾਡਾ ਕੰਮ ਛੋਟਾ ਜਿਹਾ ਅਤੇ ਸੌਖਾ ਜਿਹਾ ਕਿਉਂ ਨਾ ਹੋਵੇ ਜੇਕਰ ਅਪਰਾਧਕ ਮਾਮਲਿਆਂ ਦੀ ਗੱਲ ਕਰੀਏ ਤਾਂ ਕਾਨੂੰਨੀ ਅਧਿਕਾਰੀਆਂ ਅੱਗੇ ਆਮ ਜਨਤਾ ਦੀ ਕੋਈ ਪੇਸ਼ ਨਹੀਂ ਚਲਦੀ ਸਹੀ ਅਤੇ ਨਿਰ ਅਪਰਾਧ ਹੁੰਦੇ ਹੋਏ ਵੀ ਕਾਨੂੰਨੀ ਦਾਓ ਪੇਚਾਂ ਤੋਂ ਬਚਣਾ ਇੰਨਾ ਔਖਾ ਹੋ ਜਾਂਦਾ ਹੈ ਕਿ ਸ਼ਰੀਫ ਬੰਦਿਆਂ ਨੂੰ ਸ਼ਰਮੋ ਸ਼ਰਮੀ ਪਾਣੀ ਵਾਂਗ ਪੈਸਾ ਜਿਹੜਾ ਹੈ ਵਹਾਉਣਾ ਪੈਂਦਾ ਹੈ ਆਹ ਕੁਝ ਸਮੇਂ ਦੀ ਗੱਲ ਹੈ ਮੇਰਾ ਛੋਟਾ ਭਰਾ ਆ ਇੱਕ ਵਾਰੀ ਕਿਸੇ ਲੜਾਈ ਝਗੜੇ ਦੇ ਕੇਸ ਵਿੱਚ ਉਹ ਉਹਨੂੰ ਉਲਝਾ ਲਿਆ ਗਿਆ ਉਹ ਕੇਵਲ ਲੜਾਈ ਹੋ ਰਹੀ ਸੀ ਹੁਣ ਦੇਖਣ ਦੇ ਲਈ ਉੱਥੇ ਖੜ੍ਹਾ ਵੀ ਹੋ ਗਿਆ ਇਹੋ ਹੀ ਉਸ ਦੀ ਜਿਹੜੀ ਗਲਤੀ ਸੀ ਗਲਤੀ ਕੀ ਜੀ ਇਹ ਉਸ ਦਾ ਵੱਡਾ ਗੁਨਾਹ ਬਣ ਗਿਆ ਅਸਲੀ ਮੁਜ ਮੁਜ਼ਰਮ ਜਿਹੜੇ ਸੀਗੇ ਉਹ ਪੁਲਿਸ ਨੂੰ ਪੈਸੇ ਦੇ ਕੇ ਬਚ ਗਏ ਪੁਲਿਸ ਨੇ ਉਹਨਾਂ ਤੋਂ ਪੈਸੇ ਲਏ ਅਤੇ ਉਹਨਾਂ ਦਾ ਕੇਸ ਰਫਾ ਦਫਾ ਕਰ ਕੇ ਉਹਨਾਂ ਨੂੰ ਨੂੰ ਭੇਜ ਦਿੱਤਾ ਅਤੇ ਮਾਸੂਮ ਦੋ ਤਿੰਨ ਮੁੰਡਿਆਂ ਦੇ ਨਾਮ ਪਾ ਕੇ ਕੇਸ ਬਣਾ ਦਿੱਤਾ ਜਿਸ ਤੋਂ ਉਹਨਾਂ ਮੁੰਡਿਆਂ ਨੂੰ ਪੁਲਿਸ ਵੱਲੋਂ ਮਾਰ ਕੁੱਟ ਕੇ ਮਨਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਇਹ ਅਪਰਾਧ ਜਿਹੜਾ ਆ ਕਬੂਲ ਕਰੋ ਕਿ ਤੁਸੀਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੁਹਾਡਾ ਹੱਥ ਇਸ ਦੇ ਵਿੱਚ ਹੈ ਜੇ ਤੁਸੀਂ ਇਹ ਨਾ ਮੰਨਿਆ ਤਾਂ ਤੁਹਾਡੇ ਉੱਤੇ ਕੇਸ ਬਣਾਇਆ ਜਾਏਗਾ ਜੇਲ੍ਹ ਦੇ ਵਿੱਚ ਕੈਦ ਕੀਤਾ ਜਾਵੇਗਾ ਤੁਹਾਡੇ ਘਰਦਿਆਂ ਨੂੰ ਮੁਸ਼ਕਿਲਾਂ ਆ ਸਕਦੀਆਂ ਨੇ ਇਸ ਤਰ੍ਹਾਂ ਉਹਨਾਂ ਬੱਚਿਆਂ ਨੂੰ ਡਰਾ ਧਮਕਾ ਕੇ ਅਤੇ ਘਰ ਵਾਲਿਆਂ ਵੱਲੋਂ ਮੋਟੀ ਰਕਮ ਜਿਹੜੀ ਆ ਵਸੂਲੀ ਗਈ ਅਤੇ ਕਈ ਦਿਨ ਉਹਨਾਂ ਨੂੰ ਹਰਾਸ ਕੀਤਾ ਗਿਆ ਤਾਂ ਇਹੋ ਜਿਹੀ ਜਦੋਂ ਬਿਪਤਾ ਪੈ ਜਾਂਦੀ ਹੈ ਤਾਂ ਸ਼ਰੀਫ ਖਾਨਦਾਨ ਦੇ ਮਾਪਿਆਂ ਨੂੰ ਰਿਸ਼ਵਤਖੋਰ ਪੁਲਿਸ ਅਫ਼ਸਰਾਂ ਦੀਆਂ ਧਮਕੀਆਂ ਸੁਣਨੀਆਂ ਪਈਆਂ ਅਤੇ ਡਰਦੇ ਹੋਏ ਉਹਨਾਂ ਨੂੰ ਪੈਸੇ ਵੀ ਦੇਣੇ ਪਏ ਕਿਉਂਕਿ ਇਸ ਤੋਂ ਇਲਾਵਾ ਉਹਨਾਂ ਕੋਲ ਕੋਈ ਹੋਰ ਚਾਰਾ ਹੀ ਨਹੀਂ ਸੀ ਇਸ ਤਰ੍ਹਾਂ ਰਿਸ਼ਵਤਖੋਰੀ ਕਾਰਨ ਆਮ ਜਨਤਾ ਨੂੰ ਕਈ ਵਾਰ ਗੈਰ ਮਨੁੱਖੀ ਤਸੀਹੇ ਸਹਿਣੇ ਪੈਂਦੇ ਨੇ ਅਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਰਬਾਦੀ ਜਿਹੜੀ ਪੈਸੇ ਦੀ ਹੈ ਉਹ ਵੱਖਰੀ ਹੈ ਇਸ ਲਈ ਇਹਨਾਂ ਅਪਰਾਧੀਆਂ ਦੇ ਇਸ ਰਵੱਈਏ ਨੂੰ ਠੱਲ੍ਹ ਪਾਉਣ ਲਈ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹ ਅਜਿਹੀਆਂ ਵਧੀਕੀਆਂ ਖਿਲਾਫ਼ ਕਿੱਥੇ ਅਤੇ ਕੀ ਕਾਰਵਾਈ ਕਰ ਸਕਦੇ ਹਨ ਤਾਂ ਜੋ ਪੈਸੇ ਖਾਣ ਵਾਲੇ ਅਤੇ ਰਿਸ਼ਵਤਖੋਰ ਪੁਲਿਸ ਅਫ਼ਸਰਾਂ ਨੂੰ ਨਕੇਲ ਪਾਈ ਜਾ ਸਕੇ ਅਤੇ ਸ ਸਾਰੇ ਜਿਹੜੇ ਬੇਦੋਸ਼ੇ ਲੋਕ ਨੇ ਉਹਨਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ